ਮੇਰਾ ਨਾਮ ਦੀਪਕ ਸੁਮਿਆਲ ਹੈ ਮੈਂ ਗੁਰਦਾਸਪੁਰ ਪੰਜਾਬ ਨਿਵਾਸੀ ਹਾਂ ਮੇਰਾ ਪਿੰਡ ਹੱਲਾ ਹੈ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਮੇਰੀ ਜਿਹੜੀ ਜਿਹੜੀ ਇਹ ਖੂਬੀ ਜਿਹਨੂੰ ਅਸੀਂ ਕਹਿ ਸਕਦੇ ਇੰਗਲਿਸ਼ 'ਚ ਉਹ ਮੇਰੀ ਹੈਗੀ ਆ ਗਾਇਕੀ ਸਿੰਗਿੰਗ ਮੈਨੂੰ ਗੀਤ ਗਾਉਣਾ ਬਹੁਤ ਪਸੰਦ ਹੈ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਗੱਲ ਅਸੀਂ ਕਿਸੇ ਨੂੰ ਬੋਲ ਕੇ ਝਿੜਕ ਕੇ ਨਹੀਂ ਸਮਝਾ ਸਕਦੇ ਉਹ ਅਸੀਂ ਗੀਤ ਦੇ ਰਾਹੀਂ ਉਹਨੂੰ ਬੜੇ ਪਿਆਰ ਨਾਲ ਸਮਝਾ ਸਕਦੇ ਹਾਂ ਔਰ ਮੈਂ ਆਪਣੀ ਗਾਇਕੀ ਵਿੱਚ ਗਤੀਸ਼ੀਲਤਾ ਵਾਕਾਂਸ਼ ਜਿਹੜਾ ਵਾ ਉਹਨਾਂ ਨੂੰ ਬੜੇ ਸਹਿਜੇ ਤਰੀਕੇ ਨਾਲ ਲੈਂਦਾ ਹਾਂ ਜਿਵੇਂ ਕਿ ਮੈਨੂੰ ਪੰਜਾਬ ਦਾ ਡਾਕਟਰ ਸਤਿੰਦਰ ਸਰਤਾਜ ਜੀ ਜਿਹੜੇ ਸਿੰਗਰ ਨੇ ਉਹ ਬਹੁਤ ਪਸੰਦ ਨੇ ਕਿਉਂਕਿ ਉਹਨਾਂ ਦੀ ਜਿਹੜੀ ਲੈਅ ਹੈ ਸੁਰ ਨੇ ਗਤੀਸ਼ੀਲਤਾ ਆ ਉਹ ਮੈਨੂੰ ਬਹੁਤ ਹੀ ਪ੍ਰਭਾਵਿਤ ਕਰਦੀ ਹੈ ਉਸ ਦਾ ਕਾਰਨ ਇੱਕ ਇਹ ਵੀ ਹੈ ਕਿ ਸਰਤਾਜ ਜੀ ਦੇ ਗਾਣੇ ਬੜੇ ਵਧੀਆ ਨੇ ਔਰ ਜਦੋਂ ਮੈਂ ਆਪਣੇ ਸਮਾਜ ਵਿੱਚ ਰਹਿੰਦਾ ਜਦੋਂ ਮੈਂ ਕਿਸੇ ਪ੍ਰੋਗਰਾਮ 'ਤੇ ਜਾਂਦਾ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕੋਈ ਹੁੰਦਾ ਉੱਥੇ ਜਦੋਂ ਮੈਂ ਜਾਂਦਾ ਔਰ ਮੈਂ ਜਦੋਂ ਸੱਭਿਆਚਾਰਕ ਗੀਤ ਉੱਥੇ ਸੁਣਾਉਂਦਾ ਔਰ ਉਸ ਸੱਭਿਆਚਾਰਕ ਗੀਤ ਦੇ ਵਿੱਚ ਮੇਰੇ ਜਿਹੜੇ ਵਾਕਾਂਸ਼ ਹੁੰਦੇ ਨੇ ਉਹ ਬੜੇ ਹੀ ਸੌਖੇ ਅਤੇ ਸਰਲ ਹੁੰਦੇ ਨੇ ਜਿਸ ਕਾਰਨ ਉਹ ਬਾਕੀ ਲੋਕਾਂ ਦੇ ਜਿਹੜੇ ਮਨ ਵਿੱਚ ਬੜੀ ਜਲਦੀ ਬੈਠ ਜਾਂਦੇ ਨੇ ਔਰ ਉਹ ਬਾਕੀ ਲੋਕਾਂ ਨੂੰ ਬੜੀ ਜਲਦੀ ਸਮਝ ਵਿੱਚ ਆ ਜਾਂਦੇ ਨੇ ਇਸ ਤਰੀਕੇ ਨਾਲ ਮੈਂ ਆਪਣੀ ਗਾਇਕੀ ਮੈਨ ਮੈਨੂੰ ਲੱਗਦਾ ਕਿ ਜਿਹੜੀ ਮੇਰੀ ਗਾਇਕੀ ਹੈ ਉਹ ਮੇਰਾ ਇੱਕ ਅਜਿਹਾ ਹਥਿਆਰ ਆ ਜਿਸ ਦੇ ਨਾਲ ਮੈਂ ਜਿੰਨੇ ਵੀ ਆਪਣੇ ਸਮਾਜ ਦੇ ਵਿੱਚ ਕੁਰੀਤੀਆਂ ਨੇ ਉਹਨਾਂ ਨੂੰ ਮੈਂ ਦੂਰ ਕਰਨ ਦੇ ਵਿੱਚ ਇਸ ਦੀ ਭੂਮਿਕਾ ਨਿਭਾ ਸਕਦਾ ਹਾਂ ਸੋ ਮੈਨੂੰ ਲੱਗਦਾ ਕਿ ਹਰੇਕ ਇਨਸਾਨ ਨੂੰ ਆਪਣੇ ਸਮਾਜ ਨੂੰ ਆਪਣੇ ਆਂਢ ਗੁਆਂਢ ਨੂੰ ਜਿੱਥੇ ਅਸੀਂ ਰਹਿੰਦੇ ਹਾਂ ਰੈਣ ਬਸੇਰੇ ਨੂੰ ਠੀਕ ਰੱਖਣਾ ਚਾਹੀਦਾ ਹੈ ਔਰ ਆਪਣੀ ਜਿਹੜਾ ਵੀ ਤੁਹਾਨੂੰ ਕੋਈ ਤੁਹਾਡੇ 'ਚ ਕਲਾ ਜਿਵੇਂ ਮੇਰੇ 'ਚ ਗਾਇਕੀ ਆ ਉਹਦੇ ਰਾਹੀਂ ਸਾਨੂੰ ਬੱਚਿਆਂ ਨੂੰ ਸੇਧ ਦੇਣੀ ਚਾਹੀਦੀ ਹੈ